ਪੰਜਾਬੀ ਭਾਸ਼ਾ ਵਿੱਚ ਕਈ ਆਮ ਵਾਕ ਅਤੇ ਮੁਹਾਵਰੇ ਹਨ ਜੋ ਰੋਜ਼ਾਨਾ ਗੱਲਬਾਤ ਵਿੱਚ ਵਰਤੇ ਜਾਂਦੇ ਹਨ ਅਤੇ ਇਹ ਸਾਡੀ ਗੱਲਬਾਤ ਨੂੰ ਮਿੱਤਰੀ ਅਤੇ ਰੰਗੀਨ ਬਣਾਉਂਦੇ ਹਨ ਜਿਵੇਂ ਸਤਿ ਸ਼੍ਰੀ ਅਕਾਲ ਜਦੋਂ ਸਵੇਰੇ ਜਾਂ ਦੁਪਹਿਰ ਵਿੱਚ ਸਲਾਮ ਕਰਦੇ ਹਾਂ ਕੀ ਹਾਲ ਹੈ ਜਾਂ ਕੈਸੇ ਹੋ ਦੋਨੋਂ ਦੋਸਤਾਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਵਰਤਿਆ ਜਾਂਦਾ ਹੈ ਮੈਨੂੰ ਚੰਗਾ ਲੱਗਿਆ ਹੈ ਜਾਂ ਤੁਹਾਡੀ ਸਹਾਇਤਾ ਲਈ ਧੰਨਵਾਦ ਕਿਸੇ ਦੀ ਮਦਦ ਕਰਕੇ ਜਾਂ ਸਹੀ ਕੰਮ ਕਰਨ 'ਤੇ ਧੰਨਵਾਦ ਕਰਨ ਲਈ ਵਰਤਿਆ ਜਾਂਦਾ ਹੈ ਚੰਗਾ ਰਹੋ ਅਤੇ ਜਾਂ ਖੁਸ਼ ਰਹੋ ਸਲਾਮੀ ਦੇਣ ਜਾਂ ਵਧਾਈ ਦੇਣ ਲਈ ਵਰਤਿਆ ਜਾਂਦਾ ਹੈ ਜੀਵਨ ਦਿਲੋਂ ਜੀਓ ਜਾਅ ਜਾਂ ਅਰਥ ਹੈ ਕਿ ਜੀਵਨ ਨੂੰ ਪੂਰੀ ਮਿੱਤਰੀ ਅਤੇ ਉਤਸ਼ਾਹ ਨਾਲ ਜੀਓ ਕੁਝ ਨਾ ਕੁਝ ਲੈ ਕੇ ਆਓ ਹਰ ਥਾਂਤ ਹਮੇਸ਼ਾ ਕੁਝ ਪੈਸਾ ਜਾਂ ਕੁਝ ਲੈ ਕੇ ਆਉਣਾ ਚਾਹੀਦਾ ਹੈ ਬਕਲਮ ਕਹਿੰਦਾ ਹੈ ਮਿੱਤਰਾਂ ਦਾ ਦੇ ਨਾਲ ਸਵਾਗਤ ਕਰਨ ਦਾ ਤਰੀਕਾ ਹੈ ਹੋਰ ਮਦਦ ਚਾਹੀਦੀ ਹੈ ਜਾਂ ਕਿ ਹੋਰ ਕਰਨਾ ਹੈ ਜਦੋਂ ਕਿਸੇ ਦੀ ਮਦਦ ਪੂਰੀ ਨਹੀਂ ਹੁੰਦੀ ਜਾਂ ਹੋ ਹੋਰ ਸਹਾਇਤਾ ਦੀ ਲੋੜ ਹੁੰਦੀ ਹੈ ਧਨ ਦੀ ਕੈ ਕਦਰ ਕਰਨੀ ਚਾਹੀਦੀ ਹੈ ਦਾ ਅਰਥ ਹੈ ਕਿ ਪੈਸੇ ਦੀ ਮਹੱਤਤਾ ਸਮਝਣੀ ਚਾਹੀਦੀ ਹੈ ਬੰਦਾ ਪੂਰਾ ਹੈ ਕਿਸੇ ਦੀ ਕਦਰ ਕਰਨ ਅਤੇ ਉਸ ਦੀ ਸ਼ਕਤੀ ਦੀ ਸ਼ਕਤੀ ਜਾਂ ਸਮਰੱਥਾ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ ਚੰਗਾ ਸਮੂਹ ਦੇਣ ਮਿੱਤਰਤਾ ਦੇ ਨਾਲ ਕਿਸੇ ਨੂੰ ਸਲਾਮ ਕਰਨ ਜ ਦਾ ਇੱਕ ਤਰੀਕਾ ਹੈ ਰਾਤ ਨੂੰ ਸੌਣ ਵੇਲੇ ਮਿੱਠੀ ਬਾਤਾਂ ਦੋਸਤਾਂ ਨੂੰ ਚੰਗੀ ਵਧਾਈ ਦੇਣ ਤਸੱਲੀ ਦੇਣ ਲਈ ਵਰਤੀਆਂ ਜਾਂਦੀਆਂ ਹਨ ਬਿਨਾਂ ਪੈਸੇ ਦੇ ਕੰਮ ਨਾ ਕਰਨਾ ਪੈਸੇ ਦੀ ਮਹੱਤਤਾ ਬਤਾਉਂਦਾ ਹੈ ਆਪਣੇ ਘਰ ਦੀ ਗੱਲ ਕਰਨ ਦੀ ਬਜਾਏ ਅਰਥਾਤ ਆਪਣੀ ਨਿੱਜੀ ਮਾਮਲੇ ਦੀ ਗੱਲਬਾਤ ਕਰਨ ਦਾ ਸੁਝਾਵ ਬਾਹਰੋਂ ਬਚਣਾ ਕਿਸੇ ਨਾਲ ਝਗੜਨਾ ਤੋਂ ਬਚਣਾ ਬਚਣ ਦਾ ਮਤਲਬ ਹੈ ਪੈਸਾ ਖ਼ਤਮ ਹੋ ਗਿਆ ਲੋੜੀਂਦੀ ਗੱਲ ਨੂੰ ਵਿਆਖਿਆ ਕਰਨ ਲਈ ਵਰਤਿਆ ਜਾਂਦਾ ਹੈ ਖੁਸ਼ ਰਹੋ ਜਾਂ ਚੰਗੇ ਰਹੋ ਕਿਸੇ ਨੂੰ ਵਧਾਈ ਦੇਣ ਉਮੀਦਾਂ ਦੇ ਨਾਲ ਸਲਾਮੀ ਦੇਣ ਵਰਤੀ ਜਾਂਦੀ ਹੈ ਛੁਟਕਾਰਾ ਪੁਆਉਣਾ ਅਰਥਾਤ ਕਿਸੇ ਤੋਂ ਬਚਣ ਲਈ ਚੰਗਾ ਕਿਸੇ ਦੀ ਮਿੱਤਰਤਾ ਨੂੰ ਦਰਸਾਉਂਦਾ ਹੈ ਇਹ ਮੁਹਾਵਰੇ ਵਾਕ ਪੰਜਾਬੀ ਗੱਲਾਂ ਬਾਤਾਂ ਨੂੰ ਰੰਗੀਨ ਅਤੇ ਜਿਵੇਂ ਬਣਾਉਂਦੇ ਹਨ ਇਹ ਮੁਹਾਵਰੇ ਅਤੇ ਵਾਕ ਪੰਜਾਬੀ ਗੱਲਬਾਤ ਨੂੰ ਰੰਗੀਨ ਅਤੇ ਸੁਆਦਿਸ਼ਟ ਬਣਾਉਂਦੇ ਹਨ ਅਤੇ ਸਾਡੀ ਬੋਲਚਾਲ ਨੂੰ ਬਹੁਤ ਹੀ ਸਹੂਲਤ ਦਿੰਦੇ ਹਨ